ਹੈਲੋ ਹਾਂਜੀ ਤੁਸੀਂ ਨਾ ਗੋਰਵ ਹੋਸਪਿਟਲ ਤੋਂ ਬੋਲ ਰਹੇ ਜੀ ਮੈਨੇਜਰ ਸਾਹਿਬ ਬੋਲਦੇ ਆ ਜੀ ਅੱਛਾ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਤੁਹਾਨੂੰ ਇੱਕ ਬੇਨਤੀ ਕਰਦੀ ਸੀ ਸਰ ਜੀ ਬਈ ਤੁਸੀਂ ਨਾ ਮਤਲਬ ਕਿ ਮੈਡਮ ਇੱਕ ਬਾਰ ਬੇਨਤੀ ਸੀ ਕਿ ਮੈਂ ਨਾ ਪੰਜ ਛੇ ਦਿਨ ਤੋਂ ਉੱਥੇ ਦਵਾਈ ਲਈ ਹੋਸਪਿਟਲ ਤੋਂ ਤੁਹਾਡੇ ਤੋਂ ਅਤੇ ਤੁਹਾਡੇ ਜੇ ਥੋੜ੍ਹਾ ਜਿਹਾ ਸਾਫ਼ ਸਫਾਈ ਦਾ ਖ਼ਾਸ ਪ੍ਰਬੰਧ ਨਹੀਂ ਆ ਠੀਕ ਹੈ ਜੀ ਖਾਣ ਖਾ ਅੱਛਾ ਜੀ ਪਰ ਨਹੀਂ ਜੀ ਉਹਨਾਂ ਦਿਨਾਂ 'ਚ ਤਾਂ ਨਹੀਂ ਸੀ ਜਾਂ ਫਿਰ ਤੁਹਾਡਾ ਕੋਈ ਛੁੱਟੀ 'ਤੇ ਗਏ ਹੋਣੇ ਆ ਹਾਂਜੀ ਅਤੇ ਇੱਕ ਤਾਂ ਜੀ ਮਰੀਜ਼ ਨੂੰ ਸਮੇਂ ਸਿਰ ਖਾਣਾ ਦੇਣਾ ਜ਼ਰੂਰੀ ਹੁੰਦਾ ਇੱਕ ਇੱਕ ਦੇਖੋ ਬੈਡ ਦੀ ਸਾਫ਼ ਸਫਾਈ ਜ਼ਰੂਰੀ ਹੈ ਜੀ ਚਾਦਰ ਧੋਤੀ ਹੋਵੇ ਧੋ ਕੇ ਸੁਬਹਾ ਦੇ ਟਾਈਮ ਚਾਦਰ ਨਵੀਂ ਵਿਛਾਈ ਜਾਵੇ ਧੋ ਕੇ ਠੀਕ ਹੈ ਜੀ ਧੋਤੀ ਚਾਦਰ ਵਿਛਾਈ ਜਾਵੇ ਅਤੇ ਬਾਕੀ ਖਾਣੇ ਦਾ ਪ੍ਰਬੰਧ ਪੂਰਾ ਹੋਣਾ ਚਾਹੀਦਾ ਦਵਾਈ ਦਾ ਪ੍ਰਬੰਧ ਪੂਰਾ ਹੋਣਾ ਚਾਹੀਦਾ ਬਾਕੀ ਡਾ ਹਾਂਜੀ ਮਰੀਜ਼ ਦੇ ਕੋਲ ਨਾ ਬੈਡ ਕੋਲ ਇੱਕ ਡਸਟਬਿਨ ਹੋਣਾ ਜ਼ਰੂਰੀ ਹੈ ਜੀ ਠੀਕ ਆ ਦੇਖਿਆ ਵੀ ਕਮਰਿਆਂ ਦੇ ਵਿੱਚ ਵੀ ਹੈ ਨਹੀਂ ਸੀ ਉੱਧਰ ਸਾਡੇ ਕੋਲ ਵੀ ਹੈ ਨਹੀਂ ਸੀਗਾ ਪਰ ਮੈਂ ਸੋਚਿਆ ਵੀ ਕੋਈ ਨਹੀਂ ਮੈਨੇਜਰ ਸਾਹਿਬ ਦੇ ਧਿਆਨ 'ਚ ਲਿਆਵਾਂਗੇ ਵੀ ਥੋੜ੍ਹਾ ਜਿਹਾ ਅਤੇ ਬਾਕੀ ਇਹ ਹੈ ਜੀ ਜਦੋਂ ਬਿੱਲ ਤਿਆਰ ਹੋਵੇ ਜਦੋਂ ਛੁੱਟੀ ਮਿਲਣੀ ਹੋਵੇ ਮਰੀਜ਼ ਨੂੰ ਤਾਂ ਤੁਸੀਂ ਰਾਉਂਡ 'ਤੇ ਰਿਹਾ ਕਰੋ ਥੋੜ੍ਹਾ ਜਿਹਾ ਠੀਕ ਹੈ ਜੀ ਤੇ ਕਿਸੇ ਗਰੀਬ ਦਾ ਕੋਈ ਦੋ ਚਾਰ ਹਜ਼ਾਰ ਰੁਪਏ ਦਾ ਫ਼ਾਇਦਾ ਹੋ ਜਾਵੇ ਬਿਲ 'ਚ ਲੈੱਸ ਕਰਵਾ ਦਿਆ ਕਰੋ ਦਵਾਈਆਂ ਵੀ ਮਤਲਬ ਹਾਂਜੀ ਅਤੇ ਬਾਕੀ ਇਹ ਆ ਜੀ ਵੀ ਜੇ ਕੋਈ ਥੋੜ੍ਹੀ ਬਹੁਤ ਦਵਾਈ ਵਧ ਵੀ ਜਾਵੇ ਉਹ ਮੈਡੀਕਲ 'ਤੇ ਥੋੜ੍ਹੀ ਜਿਹੀ ਵਾਪਿਸ ਕਰਵਾ ਦਿਆ ਕਰੋ ਠੀਕ ਆ ਜੀ ਦਵਾਈ ਨਾ ਮੈਡੀਕਲ 'ਤੇ ਵਾਪਿਸ ਕਰਵਾ ਦਿਆ ਕਰੋ ਸੋ ਕੁਛ ਜਿਹੜਾ ਉਹ ਬਿੱਲ ਹੈਗਾ ਉਹ ਕੁਛ ਕੁ ਪੈਸੇ ਜਿਹੜੇ ਉਹ ਵਾਪਿਸ ਮਿਲ ਜਾਣ ਇੰਨੇ ਪੈਸੇ ਧੇਲਾ ਲਗਾਇਆ ਹੁੰਦਾ ਮਰੀਜ਼ ਨੇ ਠੀਕ ਹੈ ਇਹ ਵੇਲੇ ਫਿਰ ਖਾਣਾ ਵੀ ਦਿਆ ਕਰੋ ਇੰਨੇ ਨਾਲ ਗਰੀਬ ਖੁਸ਼ ਹੋ ਜਾਂਦਾ ਠੀਕ ਹੈ ਜੀ ਹਾਂਜੀ ਅਤੇ ਖਾਣਾ ਵੀ ਇੰਨਾ ਵਧੀਆ ਨਹੀਂ ਸੀਗਾ ਠੀਕ ਹੈ ਜੀ ਮਰੀਜ਼ ਦੇ ਖਾਣ ਵਾਲਾ ਇੰਨਾ ਖਾਣਾ ਵਧੀਆ ਨਹੀਂ ਸੀ ਹਾਂਜੀ ਹਾਂਜੀ ਉਹ ਤਾਂ ਤੁਹਾਡੇ 'ਤੇ ਨਿਰਭਰ ਆ ਜੀ ਤੁਸੀਂ ਸੈਟ ਕਿਵੇਂ ਕਰਨਾ ਮਰੀਜ਼ ਨੂੰ ਠੀਕ ਆ ਕਿਉਂਕਿ ਮਰੀਜ਼ ਨੂੰ ਪਰੇਸ਼ਾਨੀ ਨਾ ਹੋਵੇ ਇਸ ਚੀਜ਼ ਦੀ ਠੀਕ ਹੈ ਜੀ ਹਾਂਜੀ ਇਹ ਮਤਲਬ ਤੁਸੀਂ ਜ਼ਰੂਰ ਦੇਖਣਾ ਹੈਗਾ ਇੱਕ ਜਦੋਂ ਬਿੱਲ ਦਾ ਕਰਨਾ ਹੋਵੇ ਨਾ ਉਦੋਂ ਜ਼ਰੂਰ ਆ ਜਾਇਆ ਕਰੋ ਰਾਉਂਡ ਦੇ ਉੱਤੇ ਫਿਰ ਭਾਵੇਂ ਤੁਹਾਨੂੰ ਬਹੁਤ ਜ਼ਰੂਰੀ ਕੰਮ ਵੀ ਹੁੰਦਾ ਠੀਕ ਆ ਜੀ ਹਾਂਜੀ ਇੱਦਾਂ ਯਾਰ ਬਾਕੀ ਇਹ ਹੈਗਾ ਵੀ ਮਤਲਬ ਕਿ ਮਾਲਸ਼ ਵਗੈਰਾ ਜਦੋਂ ਮਤਲਬ ਕਿ ਦਵਾਈ ਵਗੈਰਾ ਦਿੰਦੇ ਹੋ ਤਾਂ ਉਦੋਂ ਤੁਸੀਂ ਨਾ ਮਾੜਾ ਜਿਹਾ ਡੇਟ ਵੇਖ ਕੇ ਦਵਾਈਆਂ ਦਵੂਈਆਂ ਦਿਆ ਕਰੋ ਕਈ ਵਾਰ ਨਾ ਡੇਟ ਓਵਰ ਹੁੰਦੀ ਆ ਅਤੇ ਕਈ ਵਾਰ ਬੱਚੇ ਉਹ ਜਿਹੜਾ ਹੁੰਦਾ ਮਰੀਜ਼ ਨੂੰ ਹਾਂਜੀ ਕਾਹਲੀ ਦੇ ਵਿੱਚ ਦੇ ਜਾਂਦੇ ਹੈਗੇ ਠੀਕ ਆ ਹਾਂਜੀ ਉਹ ਮੈਨੂੰ ਵੀ ਦਵਾਈ ਦਿੱਤੀ ਤਾਂ ਮੈਂ ਮਾੜਾ ਜਿਹਾ ਦੇਖਿਆ ਹਾਂਜੀ ਉਹ ਮੈਨੂੰ ਦਵਾਈ ਦਿੱਤੀ ਬੱਚਿਆਂ ਨੇ ਤਾਂ ਮੈਂ ਦੇਖਿਆ ਥੋੜ੍ਹਾ ਜਿਹਾ ਮਾੜਾ ਜਿਹਾ ਅਤੇ ਉਹਦੀ ਡੇਟ ਹੈ ਜਿਹੜੀ ਉਹ ਐਕਸਪਾਇਰ ਹੋ ਚੁੱਕੀ ਸੀਗੀ ਤਾਂ ਕਰਕੇ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦੀ ਸੀ ਠੀਕ ਹੈ ਹਾਂਜੀ ਅਤੇ ਇਹ ਛੋਟਾ ਜਿਹਾ ਧਿਆਨ ਰੱਖੋ ਦੇਖੋ ਜੇ ਤੁਸੀਂ ਠੀਕ ਹੈ ਜੀ ਚਲੋ ਜੀ ਹਾਂਜੀ ਇਵੇਂ ਨਾ ਜੀ ਤੁਹਾਡੇ ਬਾਹਰ ਜਾ ਕੇ ਮਰੀਜ਼ ਪ੍ਰਸ਼ੰਸਾ ਕਰੇ ਅਤੇ ਤੁਹਾਡੀ ਪ੍ਰਸ਼ੰਸਾ ਹੋਵੇ ਤੁਹਾਡੇ ਹੋਸਪੀਟਲ ਦੀ ਪ੍ਰਸ਼ੰਸਾ ਹੋਵੇ ਤੁਹਾਡਾ ਵੱਧ ਤੋਂ ਵੱਧ ਕੰਮ ਚੱਲੇ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਤੁਹਾਡਾ